ਮੇਰੀ ਜ਼ਿੰਦਗੀ ਵਿੱਚ ਜ਼ਿਆਦਾ ਤਾਂ ਕੋਈ ਵੱਡੀ ਚੁਣੌਤੀਆਂ ਨਹੀਂ ਆਈਆਂ ਪਰ ਹਾਂ ਇੱਕ ਵਾਰੀ ਮੇਰੀ ਮਾਤਾ ਕੁਛ ਦਿਨਾਂ ਲਈ ਬਾਹਰ ਚਲੇ ਗਏ ਸਨ ਜਿਸ ਕਰਕੇ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਸੀ ਮੇਰੇ ਪਾਪਾ ਆਪਣੇ ਕੰਮ 'ਤੇ ਚਲੇ ਜਾਂਦੇ ਸੀ ਛੋ ਛੋਟੀ ਭੈਣ ਵੱਡੀ ਭੈਣ ਉਹ ਸਾਰੇ ਕੰਮ 'ਤੇ ਚਲ ਜਾਂਦੇ ਸੀ ਅਤੇ ਸਾਰਾ ਕੁਛ ਮੈਨੂੰ ਸਾਂਭਣਾ ਪੈਂਦਾ ਸੀ ਜਦੋਂ ਮੇਰੀ ਮਾਤਾ ਬਾਹਰ ਗਏ ਤਾਂ ਸਾਰਾ ਕ ਕੰਮ ਮੇਰੇ ਸਿਰ 'ਤੇ ਆ ਗਿਆ ਸੀ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਟੈਂਸ਼ਨ ਹੋ ਗਈ ਸੀ ਕਿ ਮੈਂ ਕਿਵੇਂ ਸਾਂਭੂੰਗੀ ਜਾਂ ਕਿਵੇਂ ਕੁਛ ਕਰਾਂਗੀ ਸਵੇਰ ਦਾ ਕਰਕੇ ਦੁਪਹਿਰ ਦਾ ਦੁਪਹਿਰ ਦਾ ਕਰਕੇ ਰਾਤ ਦਾ ਕੱਪੜੇ ਧੋਣਾ ਝਾੜੂ ਪੋਚਾ ਕਰਨਾ ਸਭ ਕੁਛ ਕੰਮ ਇਹ ਕੋਈ ਜ਼ਿਆਦਾ ਵੱਡਾ ਔਖਾ ਵੀ ਨਹੀਂ ਹੈ ਪਰ ਮੇਰੇ ਲਈ ਪਹਿਲੀ ਵਾਰ ਸੀ ਸੋ ਤਾਂ ਕਰਕੇ ਮੈਂ ਥੋੜ੍ਹਾ ਘਬਰਾ ਗਈ ਸੀ ਮੇਰੇ ਲਈ ਇਹ ਚੁਣੌਤੀ ਦੇ ਬਰਾਬਰ ਹੀ ਸੀ ਤਾਂ ਮੇਰੀ ਵੱਡੀ ਭੈਣ ਨੇ ਮੇਰੀ ਇਸ ਵਿੱਚ ਸਹਾਇਤਾ ਕੀਤੀ ਸੀ ਉਸਨੇ ਮੈਨੂੰ ਦੱਸਿਆ ਕਿ ਇਹ ਕੰਮ ਐਵੇਂ ਕਰਨਾ ਇਹ ਕੰਮ ਐਵੇਂ ਕਰਨਾ ਇਸ ਕੰਮ ਦਾ ਇਹ ਟਾਈਮ ਹੈ ਇਸ ਕੰਮ ਦਾ ਇਹ ਟਾਈਮ ਤਾਂ ਮੈਂ ਉਹਨਾਂ ਦੀ ਸਲਾਹ ਅਨੁਸਾਰ ਸਾਰੇ ਕੰਮ ਕਰਦੀ ਗਈ ਅਤੇ ਮੈਂ ਇਸ ਨੂੰ ਐਵੇਂ ਉਹਨਾਂ ਦੀ ਮਦਦ ਨਾਲ ਪਾਰ ਕੀਤਾ ਪਰ ਇਸ ਤੋਂ ਮੈਨੂੰ ਇੱਕ ਗੱਲ ਤਾਂ ਪਤਾ ਲੱਗਾ ਕਿ ਮਾਂ ਬਿਨਾਂ ਬਹੁਤ ਔਖਾ ਹੁੰਦਾ ਹੈ ਜੇ ਮਾਂ ਨਹੀਂ ਹੁੰਦੀ ਤਾਂ ਘਰ ਘਰ ਨਹੀਂ ਲੱਗਦਾ ਸਾਰੇ ਕੰਮ ਬਹੁਤ ਜ਼ਿਆਦਾ ਔਖੇ ਹੁੰਦੇ ਹਾਂ ਅਸੀਂ ਘਰ ਵਿੱਚ ਆ ਕੇ ਆਪਣੀ ਮਾਤਾ ਨੂੰ ਕਹਿ ਦਿੰਦੇ ਸਾਨੂੰ ਇਹ ਚਾਹੀਦਾ ਏ ਸਾਨੂੰ ਇਹ ਚਾਹੀਦਾ ਪਰ ਜਦੋਂ ਮਾਂ ਨਹੀਂ ਹੁੰਦੀ ਤਾਂ ਸਾਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਤਾਂ ਸਾਨੂੰ ਉਸ ਟਾਈਮ ਮੈਨੂੰ ਬਹੁਤ ਕੁ ਔਖਾ ਹੋਇਆ ਸੀ ਘਰ ਸਾਂਭਣਾ ਪਰ ਹੌਲੀ ਹੌਲੀ ਮੈਂ ਆਪਣੀ ਬੜੀ ਭੈਣ ਦੀ ਮਦਦ ਨਾਲ ਇਹ ਸਭ ਸਾਂਭ ਲਿਆ ਸੀ